ਮੈਂ ਸਕਰੈਚ 'ਤੇ ਕੋਈ ਪਕਵਾਨ ਨਹੀਂ ਬਣਾਇਆ ਹੈ ਪਰ ਇੱਕ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਮਿਤ ਪ੍ਰੇਰਿਤ ਮੇਰੀ ਮੰਮੀ ਨੇ ਕੀਤਾ ਸੀਗਾ ਅਤੇ ਮੈਨੂੰ ਜ਼ਿਆਦਾ ਇਹ ਠੀਕ ਨਹੀਂ ਲੱਗਿਆ ਕਿਉਂਕਿ ਸਾਡਾ ਜਿਹੜਾ ਖਾਂ ਖਾਣਾ ਆਮ ਤਰ੍ਹਾਂ ਦਾ ਹੁੰਦਾ ਇਹ ਕੱਟ ਵੱਢ ਕੇ ਬਣਾਉਂਦੇ ਹਨ ਅਤੇ ਉਹ ਸਾਡੇ ਤਾਂ ਸੋਚ ਤੋਂ ਬਾਹਰ ਆ ਪਰ ਬਣਦਾ ਟੇਸਟੀ ਬਣਦਾ ਹੈ ਕ੍ਰਿਸਪੀ ਬਣਦਾ ਆ ਅਤੇ ਉਹਦੇ ਲਈ ਅਸੀਂ ਸਾਨੂੰ ਤਿਆਰੀ ਬਹੁਤ ਕਰਨੀ ਪੈਂਦੀ ਹੈ ਅਤੇ ਜੇ ਤਾਂ ਤੁਸੀਂ ਜਲਦੀ ਖਾਣਾ ਆ ਤਾਂ ਫਿਰ ਤੁਹਾਡਾ ਠੀਕ ਹੈ ਜੇ ਤੁਸੀਂ ਸਕਰੇ ਆਹਾ ਸਕਰੈਚ ਵਾਲਾ ਬਣਾਉਣਾ ਖਾਣਾ ਤਾਂ ਉਹਨੂੰ ਟਾਇਮ ਜ਼ਿਆਦਾ ਲੱਗਦਾ ਹੈ ਅਤੇ ਉਸ ਲਈ ਟਾਈਮ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਮੈਂ ਇਹ ਖਾਣਾ ਨਹੀਂ ਬਣਾਇਆ ਹਾਲੇ ਤੱਕ